ਹੈਲੋ ਹਾਂਜੀ ਮੈਂ ਬੋਲ ਰਿਹਾ ਹਾਂਜੀ ਹਾਂਜੀ ਦੱਸੋ ਐਕਚੁਲੀ ਮੈਂ ਨਾ ਔਫਿਸ ਤੋਂ ਵਾਪਿਸ ਆ ਰਿਹਾ ਸੀ ਅਤੇ ਟ੍ਰੈਫਿਕ 'ਚ ਫਸਿਆ ਹੋਇਆ ਤੁਹਾਨੂੰ ਪਤਾ ਟ੍ਰੈਫਿਕ ਦਾ ਬੜਾ ਮਾੜਾ ਹਾਲ ਹੈ ਹਰ ਚੌਂਕ ਵਿੱਚ ਕਿਤੇ ਨਾ ਕਿਤੇ ਰਸ਼ ਹੀ ਰਸ਼ ਪਿਆ ਹੋਇਆ ਵਾ ਕੀ ਲਾਈਟਾਂ ਦੀ ਪਾਲਣਾ ਨਹੀਂ ਕਰਦਾ ਸਭ ਇੱਕ ਦੂਸਰੇ ਵਿੱਚ ਕਾਹਲੀ ਕਾਹਲੀ ਫਸ ਜਾਂਦੇ ਆ ਅਤੇ ਮੁੜ ਕੇ ਰਸ਼ ਨੂੰ ਕਲੀਅਰ ਕਰਨ ਵਾਸਤੇ ਕੋਈ ਪ ਪੁਲਿਸ ਦੀ ਵਿਵਸਥਾ ਵੀ ਨਹੀਂ ਹੁੰਦੀ ਵੈਸੇ ਇਹ ਮੇਰਾ ਰੋਜ਼ ਦਾ ਹੀ ਕੰਮ ਹੈ ਇੱਥੇ ਆ ਫੇਸ ਕਰਦਾ ਮੈਂ ਪ੍ਰੋਬਲਮ ਹਾਂ ਉਹੀ ਨਾ ਨਾ ਪੈਦਲ ਵਾਲਿਆਂ ਵਾਸਤੇ ਨਾ ਰਿਕਸ਼ਾ ਵਾਲਿਆਂ ਵਾਸਤੇ ਕੋਈ ਰੂਲਿੰਗ ਹੋਈ ਹੈ ਲਾਈਟ ਜੇ ਦੂਸਰੇ ਦੀ ਹੈ ਹਾਂ ਕਹਿੰਦੇ ਤਾਂ ਹੈ ਕੈਮਰੇ ਕੀਤਾ ਵਾ ਹਲੇ ਸਟਾਰਟ ਮੇਰੇ ਖਿਆਲ ਕੀਤੇ ਨੀਗੇ ਇਹਨਾਂ ਨੇ ਤਾਂ ਹੀ ਲੋਕੀ ਨਿਡਰ ਹੋ ਕੇ ਭੱਜੇ ਫਿਰਦੇ ਹੈ ਦੱਸੋ ਤੁਸੀਂ ਨਹੀਂ ਤਾਂ ਮੈਂ ਕੋਈ ਨਾ ਤਾਂ ਫਿਰ ਤਾਂ ਕੋਈ ਗੱਲ ਨਹੀਂ ਤੁਸੀਂ ਕਰਦੋ ਠੀਕ ਠੀਕ ਓਕੇ